ਸਤਿ ਸ਼੍ਰੀ ਅਕਾਲ ਜੀ ਮੇਰੇ ਕੋਲ ਰਸੋਈ ਦੇ ਉਪਕਰਨਾਂ ਦੇ ਵਿੱਚੋਂ ਕਈ ਤਰ੍ਹਾਂ ਦੇ ਉਪਕਰਨ ਮੈਂ ਯੂਜ ਕਰਦੀ ਹਾਂ ਜੋ ਕਿ ਕੰਮ ਨੂੰ ਸੁਖਾਲਾ ਬਣਾਉਂਦੇ ਹਨ ਰਸੋਈ ਦੇ ਉਪਕਰਨਾਂ ਵਿੱਚੋਂ ਮੈਂ ਸਟੀਲ ਦੇ ਕੂਕਰ ਦਾ ਪ੍ਰਯੋਗ ਕਰਦੀ ਹਾਂ ਇਸ ਦੇ ਕਈ ਫ਼ਾਇਦੇ ਹਨ ਮੇਰੇ ਕੋਲ ਸਟੇਨਲੈਸ ਸਟੀਲ ਦਾ ਕੁੱਕਰ ਹੈ ਇਸਦੇ ਵਿੱਚ ਬਣਿਆ ਹੋਇਆ ਖਾਣਾ ਬਹੁਤ ਹੀ ਵਧੀਆ ਅਤੇ ਹਾਈਜੀਨਿਕ ਹੁੰਦਾ ਹੈ ਕੁੱਕਰ ਦੇ ਵਿੱਚ ਖਾਣਾ ਬਣਾਉਣ ਵਾਸਤੇ ਜ਼ਿਆਦਾ ਤੇਲ ਅਤੇ ਘੀ ਦੀ ਵੀ ਜ਼ਰੂਰਤ ਨਹੀਂ ਪੈਂਦੀ ਖਾਣਾ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਇਸ ਦੇ ਨਾਲ ਸਾਡੇ ਸਮੇਂ ਦੀ ਬੱਚਤ ਵੀ ਹੁੰਦੀ ਹੈ ਕਈ ਵਾਰ ਬਿਨ ਦੱਸੇ ਮਹਿਮਾਨ ਵੀ ਘਰੇ ਆ ਜਾਂਦੇ ਹਨ ਤਾਂ ਅਸੀਂ ਕੁੱਕਰ ਦੇ ਵਿੱਚ ਆਸਾਨੀ ਦੇ ਨਾਲ ਖਾਣਾ ਬਣਾ ਸਕਦੇ ਹਾਂ ਕੁਝ ਆਈਟਮਸ ਜਿਵੇਂ ਕਿ ਆਲੂ ਚਾਵਲ ਛੋਲੇ ਆਦਿ ਉਬਾਲਣੇ ਹੋਣ ਤਾਂ ਕੁੱਕਰ ਦੇ ਵਿੱਚ ਬਹੁਤ ਹੀ ਜਲਦੀ ਬਣ ਜਾਂਦੇ ਹਨ ਕੁੱਕਰ ਵੀ ਵਧੀਆ ਕੰਪਨੀ ਦਾ ਹੀ ਲੈਣਾ ਚਾਹੀਦਾ ਹੈ ਕਿਉਂਕਿ ਜੇ ਇੱਕ ਵਾਰ ਕੁੱਕਰ ਖ਼ਰੀਦ ਲਵੋ ਤਾਂ ਉਹ ਸਾਲੋ ਸਾਲ ਚੱਲਦਾ ਹੈ ਰਸੋਈ ਦੇ ਉਪਕਰਨਾਂ ਦੇ ਵਿੱਚੋਂ ਕੁੱਕਰ ਬਹੁਤ ਹੀ ਵਧੀਆ ਹੈ ਧੰਨਵਾਦ ਜੀ